ਪਾਣੀ ਦੀ ਲੋੜ ਪਾਣੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਹੈ ਸਾਨੂੰ ਪਾਣੀ ਦੀ ਬੜੇ ਧਿਆਨ ਨਾਲ ਵਰਤੋਂ ਕਰਨੀ ਚਾਹੀਦੀ ਹੈ ਹਰ ਜਗ੍ਹਾ 'ਤੇ ਪਾਣੀ ਦੀ ਵਰਤੋਂ ਜ਼ਰੂਰੀ ਹੈ ਜਿਵੇਂ ਕਿ ਪਿੰਡ ਵਿੱਚ ਪਾਣੀ ਜ਼ਮੀਨ ਵਿੱਚ ਫਸਲਾਂ ਦੇ ਲਈ ਬਹੁਤ ਜ਼ਰੂਰੀ ਹੈ ਸਾਨੂੰ ਸਵੇਰੇ ਉੱਠ ਕੇ ਨਹਾਉਣ ਤੇ ਪਾਣੀ ਦਾ ਵਰਤੋਂ ਵਾਸਤੇ ਚਾਹੀਦਾ ਹੈ ਪਾਣੀ ਬਰਤਨਾਂ ਵਾਸਤੇ ਕੱਪੜਿਆਂ ਵਾਸਤੇ ਨਹਾਉਣ ਵਾਸਤੇ ਅਤੇ ਹਰ ਕੰਮ ਵਾਸਤੇ ਪਾਣੀ ਦੀ ਵਰਤੋਂ ਬਹੁਤ ਜ਼ਰੂਰੀ ਹੈ ਪਾਣੀ ਦਾ ਆਉਣਾ ਬਹੁਤ ਜ਼ਰੂਰੀ ਹੈ ਸਫਾਈ ਵਾਸਤੇ ਜਿਵੇਂ ਕਿ ਸਫਾਈ ਕਰਨ ਵਾਲੀਆਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਪੈਂਦੀ ਹੈ ਪਾਣੀ ਹਰ ਜਗ੍ਹਾ 'ਤੇ ਬਹੁਤ ਜ਼ਰੂਰੀ ਹੈ ਪੀਣ ਦੇ ਕੰਮ ਬੜਾ ਆਉਂਦਾ ਹੈ ਜੀ ਸਬਜ਼ੀ ਵਾਸਤੇ ਸਫਾਈ ਵਾਸਤੇ ਨਹਾਉਣ ਵਾਸਤੇ ਕੱਪੜੇ ਧੋਣ ਵਾਸਤੇ ਆਟਾ ਗੁੰਨ੍ਹਣ ਵਾਸਤੇ